ਸਤਿ ਸ਼੍ਰੀ ਅਕਾਲ ਭਾਅ ਜੀ ਵਿਸ਼ਵ ਜੀ ਗੱਲ ਕਰਦੇ ਜੀ ਗਗਨਦੀਪ ਸਿੰਘ ਗੱਲ ਕਰ ਰਿਹਾ ਜੀ ਠੀਕ ਹੈ ਜੀ ਗਗਨਦੀਪ ਸਿੰਘ ਗਗਨਦੀਪ ਸਿੰਘ ਗੱਲ ਕਰਦਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਤੁਸੀਂ ਸੁਣਾਓ ਮੈਨੂੰ ਭਾਅ ਜੀ ਆਪਣਾ ਅਮਰੀਕ ਸਿੰਘ ਨੇ ਨੰਬਰ ਦਿੱਤਾ ਤਾ ਜੀ ਤੁਹਾਡਾ ਮੈਂ ਨਾ ਨਵਾਂ ਸ਼ਹਿਰ ਨਾ ਹੁਣ ਸ਼ਿਫਟ ਕੀਤਾ ਜੀ ਅਤੇ ਮੈਂ ਹੁਣ ਇੱਥੇ ਰਹਿਣਾ ਰਹਿਣ ਆਇਆ ਜੀ ਉਰੇ ਅਤੇ ਮੈਂ ਕੱਲ੍ਹ ਸ਼ਾਮ ਨਾ ਪਤਾ ਕੀ ਹੋਇਆ ਮੈਂ ਸਬਜ਼ੀਆਂ ਲੈਣ ਚਲਾ ਗਿਆ ਜੀ ਇੱਥੋਂ ਮਾਰਕੀਟ ਤੋਂ ਉਹ ਜਿੱਦਾਂ ਹੀ ਘਰ ਲਿਆਉਂਦੀਆਂ ਇੱਕ ਤਾਂ ਉਹਨਾਂ ਦੀ ਦੇਖਣ ਤੋਂ ਹੀ ਠੀਕ ਨਹੀਂ ਤੀਆਂ ਵੈਸੇ ਚਲੋ ਮੈਂ ਲੈ ਤਾਂ ਲਈਆਂ ਹੁਣ ਕਿਉਂਕਿ ਰਾਤ ਤਾਂ ਲੋੜ ਤੀ ਫਿਰ ਉਹ ਹੈ ਨਹੀਂ ਇੰਨੀ ਵਧੀਆ ਰਹੀਆਂ ਜਾਣੀ ਕਿ ਖਰਾਬ ਜੀਆਂ ਹੋ ਗਈਆਂ ਸਵੇਰ ਤੱਕ ਤਾਂ ਸੁੱਕ ਗਈਆਂ ਸਬਜ਼ੀਆਂ ਤੁਸੀਂ ਦੱਸ ਸਕਦੇ ਹੋ ਕਿ ਇੱਥੇ ਕਿਹੜੀ ਵਧੀਆ ਮਾਰਕੀਟ ਆ ਜਿੱਥੇ ਵਧੀਆ ਤਾਜ਼ਾ ਸਬਜ਼ੀ ਮਿਲਦੀ ਹੋਵੇ ਹਾਂਜੀ ਦੱਸੋ ਜੀ ਹਾਂਜੀ

ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਅਤੇ ਆਪਣਾ ਫਰੂਟ ਵਗੈਰਾ ਵੀ ਮਿਲ ਜਾਂਦੇ ਜੀ ਠੀਕ ਅੱਛਾ ਜੀ ਠੀਕ ਹੈ ਜੀ ਕੋਈ ਨਹੀਂ ਦੇਖਾਂਗੇ ਜਾ ਕੇ ਹੋਰ ਸੁਣਾਓ ਜੀ ਠੀਕ ਠਾਕ ਹੈ ਜੀ